ਮੁਰਗੀਆਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਘੇਰਦੀਆਂ ਹਨ ਮੁਰਗੀਆਂ ਨੂੰ ਮੁਰਗੀ ਫਾਰਮ ਦੀ ਸਾਫ ਸਫਾਈ ਦਾ ਬਹੁਤ ਧਿਆਨ ਰੱਖਣਾ ਪੈਂਦਾ ਸਾਨੂੰ ਸਮੇਂ ਸਮੇਂ 'ਤੇ ਐਂਟੀ ਵਾਇਰਸ ਸਪਰੇ ਦਾ ਛਿੜਕਾਓ ਕਰਨਾ ਪੈਂਦਾ ਹੈ ਮੁਰਗੀਆਂ ਜਿਹੜੀਆਂ ਹਨ ਉਹਨਾਂ ਦੇ ਖਾਣੇ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਫੀਡ ਦਾ ਧਿਆਨ ਰੱਖਣਾ ਪੈਂਦਾ ਉਹਨਾਂ ਨੂੰ ਕੈਲਸ਼ੀਅਮ ਦੀ ਘਾਟ ਆ ਜਾਂਦੀ ਹੈ ਉਹਨਾਂ 'ਚ ਬਰੀਕ ਕੰਕਰ ਵੀ ਪੋਲਟਰੀ ਫਾਰਮ ਦੇ ਵਿੱਚ ਖਿਲਾਰਨੇ ਪੈਂਦੇ ਹਨ ਕਿ ਉਹ ਕੰਕਰ ਚੁਗਣ ਅਤੇ ਅੰਡੇ ਦੀ ਗੁਣਵੱਤਾ ਵਧੀਆ ਹੋਵੇ ਕਿਉਂਕਿ ਕੈਲਸ਼ੀਅਮ ਦੀ ਬੜੀ ਘਾਟ ਆਉਂਦੀ ਅੰਡੇ ਦੀ ਪਰਤ ਜਿਹੜੀ ਉਹ ਤਕਰੀਬਨ ਕੈਲਸ਼ੀਅਮ ਦੀ ਘਾਟ ਨੂੰ ਵਧਾਉਂਦੀ ਹੈ ਬਾਹਰੀ ਪਰਤ ਜਿਹੜੀ ਅੰਡੇ ਦੀ ਹੁੰਦੀ ਹੈ ਇਸ ਕਰਕੇ ਅਸੀਂ ਜੇਕਰ ਘਰੇਲੂ ਹੱਲ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ ਲੇਕਿਨ ਫਿਰ ਵੀ ਜੇਕਰ ਕੋਈ ਜ਼ਿਆਦਾ ਹੀ ਬਿਮਾਰੀ ਕੋਈ ਦਿਖੇ ਤਾਂ ਅਸੀਂ ਫਿਰ ਮੁਰਗੀਆਂ ਦੇ ਮਾਹਰ ਡਾਕਟਰ ਨੂੰ ਜਿਹੜਾ ਕਿ ਵੈਟਰਨੀ ਦੇ ਰਾਹੀਂ ਬੁਲਾਉਂਦੇ ਹਾਂ ਅਤੇ ਉਹਨਾਂ ਨੂੰ ਕਾਲ ਕਰਦੇ ਹਾਂ ਅਤੇ ਉਹ ਆ ਕੇ ਸਾਡੀ ਜਾਂਚ ਕਰਦੇ ਹੈ